ਮੇਰਾ ਮਨ ਪਸੰਦ ਗੈਜਡ ਹੈ ਮੋਬਾਈਲ ਫੋਨ ਕਿਉਂਕਿ ਮੋਬਾਈਲ ਫੋਨ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜੇਕਰ ਮੈਂ ਆਪਣੀ ਗੱਲ ਕਰਾਂ ਮੇਰੇ ਰੋਜ਼ਾਨਾ ਜੀਵਨ ਵਿੱਚ ਉਹ ਕਿਵੇਂ ਲਾਭ ਪੁਜਾਦਾ ਹੈ ਤਾਂ ਮੈਂ ਦੱਸਦਾ ਹਾਂ ਕਿ ਫੋਨ ਜੋ ਹੈ ਮੋਬਾਈਲ ਫੋਨ ਉਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਨਾ ਕਿ ਮੇਰੇ ਵਾਸਤੇ ਬਲਕਿ ਪੂਰੇ ਜਗਤ ਵਾਸਤੇ ਕਿਉਂਕਿ ਪਹਿਲੀ ਗੱਲ ਪੰਜਾਬ ਫੋਨਾਂ ਨਾਲ ਅਸੀਂ ਕਿਸੇ ਨੂੰ ਵੀ ਫੋਨ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਪੰਜਾਬ ਵਿੱਚ ਬੈਠੇ ਹਾਂ ਅਤੇ ਦੂਸਰਾ ਬੰਦਾ ਦਿੱਲੀ ਵਿੱਚ ਬੈਠਾ ਹੈ ਤਾਂ ਉਂਝ ਵੀ ਅਸੀਂ ਉਸ ਨਾਲ ਗੱਲ ਕਰ ਸਕਦੇ ਹਾਂ ਵੀਡੀਓ ਕਾਲ ਕਰ ਸਕਦੇ ਹਾਂ ਸਿੰਪਲ ਕਾਲ ਕਰ ਸਕਦੇ ਹਾਂ ਜਾਂ ਫਿਰ ਮੈਸੇਜ ਦੇ ਥਰੂ ਵੀ ਗੱਲ ਕਰ ਸਕਦੇ ਹਾਂ ਇਸ ਵਾਸਤੇ ਵੱਖਰੇ ਵੱਖਰੇ ਐਪ ਬਣੇ ਹਨ ਫੋਨਾਂ ਵਿੱਚ ਫੋਨਾਂ ਨਾਲ ਅਸੀਂ ਕੋਈ ਵੀ ਚੀਜ਼ ਸਮਝ ਸਕਦੇ ਹਾਂ ਖਬਰਾਂ ਪੜ੍ਹ ਸਕਦੇ ਹਾਂ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੀ ਗੱਲਬਾਤ ਹੋ ਰਹੀ ਹੈ ਉਹ ਪੜ੍ਹ ਸਕਦੇ ਹਾਂ ਪੂਰੇ ਪੰਜਾਬ ਪੂਰੇ ਭਾਰਤ ਪੂਰੇ ਵਰਲਡ ਬਾਰੇ ਪੜ੍ਹ ਸਕਦੇ ਹਾਂ ਅਤੇ ਹੋਰ ਜੇਕਰ ਦੱਸਾਂ ਮੈਂ ਤਾਂ ਫੋਨਾਂ ਵਿੱਚ ਅੱਜ ਕੱਲ੍ਹ ਅਸੀਂ ਓਨਲਾਈਨ ਬਹੁਤ ਕੁਝ ਕਰ ਸਕਦੇ ਹਾਂ ਆਪਣੇ ਕੱਪੜੇ ਖਰੀਦ ਸਕਦੇ ਹਾਂ ਘਰ ਦਾ ਸਮਾਨ ਖਰੀਦ ਸਕਦੇ ਹਾਂ ਪੈਸੇ ਵਗੈਰਾ ਇੱਕ ਦੂਜੇ ਨੂੰ ਦੇ ਸਕਦੇ ਹਾਂ ਟ੍ਰਾਂਸਫਰ ਕਰ ਸਕਦੇ ਹਾਂ ਟ੍ਰੇਨਾਂ ਬੁੱਕ ਕਰ ਸਕਦੇ ਹਾਂ ਖਾਣ ਪੀਣ ਦਾ ਪ੍ਰੋਗਰਾਮ ਕਰ ਸਕਦੇ ਹਾਂ ਆਪਣੇ ਘਰ ਬੈਠੇ ਹੀ ਮੰਗਵਾ ਸਕਦੇ ਹਾਂ ਕੁਛ ਵੀ ਅੱਜ ਕੱਲ੍ਹ ਮੁਮਕਿਨ ਹੈ ਫੋਨਾਂ ਕਰਕੇ ਜਿਸ ਕਰਕੇ ਮੈਨੂੰ ਫੋਨ ਬਹੁਤ ਹੀ ਵਧੀਆ ਲੱਗਦੇ ਹਨ ਅਤੇ ਸਭ ਤੋਂ ਵੱਡੀ ਗੱਲ ਹੈ ਇਹ ਮਨੋਰੰਜਨ ਦਾ ਬਹੁਤ ਵੱਡਾ ਸਾਧਨ ਹੈ ਕਿਉਂਕਿ ਫੋਨਾਂ ਨਾਲ ਅਸੀਂ ਯੂਟਿਊਬ 'ਤੇ ਕੁਝ ਵੀ ਆਪਣਾ ਮਨ ਪਸੰਦ ਜੋ ਸਾਨੂੰ ਅੱਛਾ ਲੱਗੇ ਜੋ ਸਾਡੇ ਦਿਲ ਨੂੰ ਭਾਏ ਅਸੀਂ ਉਹ ਅਸੀਂ ਉਹ ਦੇਖ ਸਕਦੇ ਹਾਂ ਧੰਨਵਾਦ